ਹਾਂਜੀ ਇਹ ਕਾਫੀ ਚਰਚਾ ਦਾ ਵਿਸ਼ਾ ਹੈ ਅੱਜ ਕੱਲ੍ਹ ਪੰਜਾਬੀ ਭਾਸ਼ਾ ਕਈ ਲੋਕ ਕਹਿੰਦੇ ਹੈ ਕਈ ਆਮ ਗਲਤ ਧਾਰਨਾਵਾਂ ਬਣੀਆਂ ਹੋਈਆਂ ਹਨ ਜੋ ਕਿ ਬਿਲਕੁਲ ਸਹੀ ਹੈ ਅੱਜ ਦੇ ਅੱਜ ਦੇ ਯੁੱਗ ਵਿੱਚ ਅਤੇ ਕਈ ਪੰਜਾਬੀ ਇਹਨੂੰ ਮਾਨ ਨਹੀਂ ਸਮਝਦੇ ਬੋਲਣਾ ਕਿਉਂ ਬੀਕੋਜ਼ ਵੈਸਟਨ ਕਲਚਰ ਦਾ ਇੱਕ ਤਾਂ ਜ਼ਿਆਦਾ ਪ੍ਰਭਾਵ ਪਾਇਆ ਗਿਆ ਔਰ ਕਿਸੇ ਦੂਜੇ ਸ਼ਹਿਰ 'ਚ ਜਾਂਦੇ ਹਾਂ ਤਾਂ ਸਮਝਦੇ ਹਾਂ ਕਿ ਵੀ ਹਾਂ ਇਹ ਤਾਂ ਪੇਂਡੂ ਲੋਕ ਹੈ ਬਈ ਇਹ ਪੂਰੀ ਠੇਠ ਪੰਜਾਬੀ ਬੋਲਦੇ ਹਨ ਈਵਨ ਕਈ ਸਕੂਲ ਹੈਗੇ ਹੈ ਜੋ ਕਿ ਪੰਜਾਬ ਵਿੱਚ ਜੋ ਕਿ ਇਟਰਡਿਊਸ ਹੀ ਨਹੀਂ ਕਰ ਰਹੇ ਪੰਜਾਬੀ ਅਤੇ ਪੰਜਾਬੀ ਨੂੰ ਜ਼ਿਆਦਾ ਲੈਂਗਵੇਜ਼ ਨੂੰ ਹੋਰ ਪਰੈਫਰੈਂਸ ਦਿੱਤਾ ਜਾ ਰਿਹਾ ਰੇਦਰ ਦੈਨ ਪੰਜਾਬੀ ਸੋ ਆਪਾਂ ਫਸਟ ਤੋਂ ਪਹਿਲਾਂ ਸਾਨੂੰ ਇੱਕ ਸਾਰਿਆਂ ਨੂੰ ਹੱਲਾ ਮਾਰਨਾ ਪੈਣਾ ਹੈ ਇਹਦੇ ਲਈ ਪਹਿਲਾਂ ਤਾਂ ਪ ਅ ਸਕੂਲਾਂ ਵਿੱਚ ਹੋ ਸਕੇ ਤਾਂ ਪੰਜਾਬੀ ਇੱਕ ਕੰਪਲਸਰੀ ਹੋਣੀ ਚਾਹੀਦੀ ਹੈ ਲਾਜ਼ਮੀ ਕਰ ਦੇਣੀ ਚਾਹੀਦੀ ਹੈ ਦੂਸਰਾ ਪੇਰੈਂਟਸ ਬੱਚਿਆਂ ਦੇ ਜਿਹੜੇ ਮਾਂ ਪਿਉ ਹੈ ਉਹਨਾਂ ਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਘਰ ਵਿੱਚ ਵੀ ਪੰਜਾਬੀ ਬੋਲਣੀ ਚਾਹੀਦੀ ਹੈ ਔਰ ਉਹਨਾਂ ਨੂੰ ਪੰਜਾਬੀ ਦੱਸਣੀ ਚਾਹੀਦੀ ਹੈ ਵੀ ਇਹਦਾ ਪਿਛੋਕੜ ਕੀ ਹੈ ਵੀ ਇਹ ਸਾਡੀ ਮਾਂ ਬੋਲੀ ਹੈ ਅਤੇ ਇਹਦਾ ਇਤਿਹਾਸ ਕੀ ਹੈ ਅਤੇ ਉਹ ਅਵੇਅਰ ਹੋਣਗੇ ਅਤੇ ਉਹਨਾਂ ਨੂੰ ਪਤਾ ਲੱਗੇਗਾ ਵੀ ਸਾਡਾ ਕਲਚਰ ਕੀ ਹੈ ਅਤੇ ਅਸੀਂ ਕਿੱਥੇ ਜਾਣਾ ਹੈ